ਸਾਡੇ ਪਟਿਆਲੇ ਸ਼ਹਿਰ ਵਿੱਚ ਸਿਲਾਈ ਬੁਣਾਈ ਦਾ ਕੰਮ ਬਹੁਤ ਹੀ ਵਿਲੱਖਣ ਤਰੀਕੇ ਨਾਲ ਕੀਤਾ ਜਾਂਦਾ ਹੈ ਇੱਥੇ ਦਰਜੀਆਂ ਵਾਲੀ ਗਲੀ ਵਿੱਚ ਸਪੈਸ਼ਲ ਦਰਜੀ ਹਨ ਜੋ ਕਿ ਅਲੱਗ ਤੋਂ ਕਢਾਈਆਂ ਕਰਦੇ ਹਨ ਜਿਵੇਂ ਕਿ ਕਢਾਈਆਂ ਦੇ ਕਈ ਸਾਰੇ ਤਰੀਕੇ ਹੁੰਦੇ ਹਨ ਜਿਵੇਂ ਕਿ ਦਬਕੇ ਦਾ ਕੰਮ ਪੇ ਜਾਂ ਫਿਰ ਸਿਲਾਈ ਮਸ਼ੀਨ ਦੇ ਧਾਗੇ ਦਾ ਕੰਮ ਜਾਂ ਫਿਰ ਹੋਰ ਕਈ ਕਢਾਈਆਂ ਹੁੰਦੀਆਂ ਹਨ ਤਿੱਲੇ ਦਾ ਕੰਮ ਮੈਨੂੰ ਇਹਨਾਂ ਸਾਰਿਆਂ ਦੇ ਵਿੱਚੋਂ ਦਬਕੇ ਦਾ ਕੰਮ ਜਿਹੜਾ ਕੀਤਾ ਹੁੰਦਾ ਹੈ ਅਗਰ ਤੁਸੀਂ ਦੇਖੋ ਤਾਂ ਓਹਨੂੰ ਕੁੱਟ ਕੇ ਕਢਾਈ ਕਰਕੇ ਕੁੱਟ ਕੇ ਅਗਰ ਓਹਨੂੰ ਕੀਤਾ ਜਾਵੇ ਤਾਂ ਓਹਨੂੰ ਪਿੱਤਾ ਬੋਲਦੇ ਹਨ ਇਹ ਪਿੱਤੇ ਦਾ ਕੰਮ ਬਹੁਤ ਹੀ ਬਰੀਕੀ ਕੰਮ ਹੈ ਜੋ ਕਿ ਪਟਿਆਲੇ ਸ਼ਹਿਰ ਦੇ ਵਿੱਚ ਤੁਹਾਨੂੰ ਆਮ ਮਿਲ ਜਾਵੇਗਾ ਮੈਂ ਇੱਕ ਲਹਿੰਗਾ ਤਿਆਰ ਕਰਵਾਇਆ ਜਿਹਦੇ ਵਿੱਚ ਦਬਕੇ ਦਾ ਕੰਮ ਧਾਗੇ ਦਾ ਕੰਮ ਅਤੇ ਉਸ ਦੇ ਨਾਲ ਨਾਲ ਪਿੱਤੇ ਦਾ ਕੰਮ ਵੀ ਸੀਗਾ ਇਹ ਇੱਕ ਬਹੁਤ ਹੀ ਪਿਆਰਾ ਲਹਿੰਗਾ ਤਿਆਰ ਹੋਇਆ ਅਗਰ ਇਹਨੂੰ ਧਿਆਨ ਨਾਲ ਦੇਖੀਏ ਤਾਂ ਓਹ ਦੂਰੋ ਇਵੇਂ ਲਗਦਾ ਹੈ ਕਿ ਜਿਵੇਂ ਦਬਕੇ ਦਾ ਹੀ ਇਕੱਲਾ ਕੰਮ ਹੈ ਜਦੋਂ ਤੁਸੀਂ ਓਹਨੂੰ ਬਰੀਕੀ ਦੇ ਨਾਲ ਦੇਖਦੇ ਹੋ ਤਾਂ ਓਹਦੇ ਵਿੱਚ ਜੋ ਤੁਸੀਂ ਪਿੱਤੇ ਦਾ ਕੰਮ ਦੇਖਦੇ ਹੋ ਤਾਂ ਤੁਹਾਨੂੰ ਉਹ ਇੱਕ ਅਲੱਗ ਤੋਂ ਹੀ ਉਹ ਉਸ ਦੀ ਜਿਹੜੀ ਹੈਗੀ ਆ ਆਕਰਸ਼ਣ ਹੈ ਓਹਦਾ ਵਧਾ ਦਿੰਦਾ ਹੈ ਤਾਂ ਇਹੋ ਜਿਹੀਆਂ ਜਿਹੜੀਆਂ ਕਢਾਈਆਂ ਨੇ ਖਾਸ ਓਹ ਤੁਹਨੂੰ ਇਸ ਖੇਤਰ ਦੇ ਵਿੱਚ ਹੀ ਮਿਲਣਗੀਆਂ